ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਨਪ੍ਰੀਤ ਕੌਰ ਹੈ ਮੈਂ ਪਠਾਨਕੋਟ ਤੋਂ ਗੱਲ ਕਰਦੀ ਪਈ ਹਾਂ ਅੰਮ੍ਰਿਤਸਰ ਦੀ ਹਰਿਮੰਦਰ ਸਾਹਿਬ ਦੀ ਅੰਮ੍ਰਿਤਸਰ ਵਿੱਚ ਕਾਫ਼ੀ ਜ਼ਿਆਦਾ ਮਹੱਤਤਾ ਹੈ ਜਿਹੜਾ ਅੰਮ੍ਰਿਤਸਰ ਵਾ ਉਹ ਹਰਿਮੰਦਰ ਸਾਹਿਬ ਬਿਨਾਂ ਕੁਝ ਵੀ ਨਹੀਂ ਹੈ ਜਿਹੜਾ ਹਰਿਮੰਦਰ ਸਾਹਿਬ ਹੈ ਉਹਦੇ ਕਰਕੇ ਹੀ ਇੱਕ ਸਲੂ ਜਾਂਦੇ ਹਨ ਅੰਮ੍ਰਿਤਸਰ ਦੇ ਇੰਨਾ ਜਿਹੜਾ ਨਾਮ ਆ ਉਹ ਮਤਲਬ ਕਿ ਮਸ਼ਹੂਰ ਹੈ ਹਰਿਮੰਦਰ ਸਾਹਿਬ ਵੀ ਬਸ ਕਿ ਇੱਕ ਇਹੋ ਜਿਹੀ ਮਤਲਬ ਕਿ ਸਥਾਨ ਹੈ ਜਿਹਦੇ ਲੋਕ ਦਰਸ਼ਨ ਕਰਨ ਜਾਂਦੇ ਹਨ ਅਤੇ ਇਸ ਕਰਕੇ ਅੰਮ੍ਰਿਤਸਰ ਵੀ ਬਹੁਤ ਮਸ਼ਹੂਰ ਹੈ ਮੈਨੂੰ ਉੱਥੇ ਜਾਣ ਦਾ ਮੌਕਾ ਕਈ ਵਾਰ ਮਿਲਿਆ ਹੈ ਅਤੇ ਮੈਂ ਇੱਥੇ ਕਾਫ਼ੀ ਵਾਰ ਗਈ ਵੀ ਹੋਈ ਹਾਂ ਹਰਿਮੰਦਰ ਸਹਿਬ ਜਾ ਕੇ ਰਸ ਆਪਣੇ ਮੇਰੇ ਮਨ ਨੂੰ ਜਿਹੜਾ ਹੈ ਸਕੂਨ ਮਿਲਿਆ ਇੱਥੇ ਜਿਹੜੇ ਕੇ ਗੁਰੂਆਂ ਜਿਹੜੇ ਆਪਾਂ ਇਤਿਹਾਸਿਕ ਪਿਛੋਕੜ ਬਾਰੇ ਮੈਂ ਜਾਣਿਆ ਇੱਥੇ ਦੇ ਇਸ਼ਨਾਨ ਕੀਤਾ ਸਰੋਵਰ ਦੇ ਵਿੱਚ ਲੰਗਰ ਖਾਦਾ ਅਤੇ ਹਰ ਚੀਜ਼ ਵੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹਰਿਮੰਦਰ ਸਾਹਿਬ ਵਰਗੀ ਜਗ੍ਹਾ ਇੱਥੇ ਕੋਈ ਦੁਨੀਆ ਵਿੱਚ ਹੀ ਕਿਤੇ ਵੀ ਹੈ ਨਹੀਂ ਆ ਜਿਹੜਾ ਹਰਿਮੰਦਰ ਸਾਹਿਬ ਹੈ ਗੁਰੂਆਂ ਦੀ ਪੀਰਾਂ ਦੀ ਜਿਹੜੀ ਪਾ ਪਾਵਨ ਧਰਤੀ ਹੈ ਜਿਹੜੇ ਸਾਡੇ ਗੁਰੂ ਨੇ ਗੁਰੂ ਮਹਾਰਾਜ ਜੋ ਵੀ ਨੇ ਜੋ ਵੀ ਸਾਨੂੰ ਸੰਦੇਸ਼ ਦਿੱਤੇ ਹਨ ਉਹਨਾਂ ਬਾਰੇ ਅਸੀਂ ਜਾਣਦੇ ਹਾਂ ਬੈਠ ਕੇ ਅਸੀਂ ਕੜਾਹ ਪ੍ਰਸ਼ਾਦਿ ਦੀ ਦੇਗ਼ ਉਹ ਅਸੀਂ ਖਾਂਦੇ ਵੀ ਹਾਂ ਅਤੇ ਕਰਵਾਉਂਦੇ ਵੀ ਹਾਂ ਅਸੀਂ ਇੱਥੇ ਬੈਠ ਕੇ ਲੋਕਾਂ ਵਿੱਚ ਮਤਲਬ ਕਿ ਬੈਠ ਕੇ ਉੱਥੇ ਗੁਰੂ ਘਰ ਜਾ ਕੇ ਅਸੀਂ ਸਕੂਨ ਜਿਹੜਾ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਉਹ ਸਾਨੂੰ ਕਿਤੇ ਵੀ ਨਹੀਂ ਮਿਲਦਾ ਅਤੇ ਜਿਹੜਾ ਇੱਥੇ ਜਾ ਕੇ ਜਿਹੜਾ ਗੁਰੂ ਘਰ ਦਾ ਲੰਗਰ ਹੈ ਉਹੋ ਜਿਹਾ ਸੁਆਦ ਵੀ ਕਿਤੇ ਕਿਸੇ ਹੋਸਟਲ ਹੋਟਲ ਜਾਂ ਕਿਸੇ ਰੈਸਟੋਰੈਂਟ ਦੇ ਖਾਣੇ ਵਿੱਚ ਕਿਤੇ ਨਹੀਂ ਹੈ ਅਤੇ ਗੁਰੂ ਘਰ ਦੀ ਦਿਵਾਲੀ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਅੰਮ ਕਹਿੰਦੇ ਕਿ ਦਾਲ ਰੋਟੀ ਘਰ ਅਤੇ ਦਿਵਾਲੀ ਅੰਬਰਸਰ ਦੀ ਉਹ ਹੀ ਗੱਲ ਹੈ ਕਿ ਮੈਨੂੰ ਪਰ ਕਦੇ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਦਾ ਕਦੇ ਮੌਕਾ ਨਹੀਂ ਮਿਲਿਆ ਜਾਂ ਭੀੜ ਭੜੱਕੇ ਤੋਂ ਡਰਦਿਆਂ ਕਦੇ ਆਪਾਂ ਦੀਵਾਲੀ ਜ਼ਰੂਰ ਕਦੇ ਨਹੀਂ ਦੇਖੀ ਅੰਮ੍ਰਿਤਸਰ ਦੀ ਕਦੇ ਮੈਨੂੰ ਮੋਕਾ ਮਿਲਿਆ ਤਾਂ ਮੈਂ ਇਹ ਵੀ ਜ਼ਰੂਰ ਦੇਖਣਾ ਚਾਹਵਾਂਗੀ ਪਰ ਜੋ ਅੰਮ੍ਰਿਤਸਰ ਜਿਹੜਾ ਵਾ ਉਹ ਹੈ ਹੀ ਹਰਮੰਦਰ ਸਾਹਿਬ ਦੇ ਕਰਕੇ ਹੈ ਹਰਮੰਦਰ ਸਾਹਿਬ ਵਰਗੀ ਜਗ੍ਹਾ ਤਾਂ ਕੋਈ ਵੀ ਨਹੀਂ ਹੈ ਹਰਿਮੰਦਰ ਸਾਹਿਬ ਦਾ ਜਿਹੜਾ ਪਿਛੋਕੜ ਹੈ ਜਿਹੜਾ ਇਤਿਹਾਸ ਹੈ ਜਿਹੜਾ ਗੁਰੂਆਂ ਦਾ ਇਤਿਹਾਸ ਹੈ ਇਹ ਬਹੁਤ ਹੀ ਵੱਡਾ ਅਤੇ ਬਹੁਤ ਹੀ ਪਾਵਨ ਇਤਿਹਾਸ ਆ ਇਹ ਜਾਣਨਾ ਇਹ ਪੜ੍ਹਨਾ ਇਹ ਕਾਫ਼ੀ ਜ਼ਿਆਦਾ ਇੱਕ ਰੁਚੀ ਭਰਿਆ ਕੰਮ ਹੈ ਅਤੇ ਇਹ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਕਿ ਮੈਂ ਮੈਨੂੰ ਮੈਂ ਚਾਹੰਦੀ ਕਿ ਮੈਨੂੰ ਫਿਰ ਕਦੇ ਮੌਕਾ ਮਿਲੇ ਤਾਂ ਮੈਂ ਹਰਿਮੰਦਰ ਸਾਹਿਬ ਜ਼ਰੂਰ ਹੀ ਜਾਵਾਂਗੀ